ਪੰਜਾਬ ਦੀ ਜਿਹੜੀ ਮਾਂ ਬੋਲੀ ਆ ਉਹ ਪੰਜਾਬੀ ਆ ਜਿਹੜੇ ਪੰਜਾਬ ਦੇ ਲੋਕ ਆ ਉਹ ਹਰ ਇੱਕ ਜਿਹੜਾ ਉਹ ਪੰਜਾਬੀ ਹੀ ਬੋਲਦਾ ਆ ਜਿਹੜੇ ਇੱਥੇ ਬਾਹਰੋਂ ਆਉਂਦੇ ਆ ਉਹਦੇ ਵਿੱਚ ਪੰਜਾਬ ਵਿੱਚ ਕੋਈ ਵੀ ਲੋਕ ਉਹ ਪੰਜਾਬੀ ਬੋਲਣੀ ਸਿੱਖਦੇ ਨੇ ਜਿਹਨਾਂ ਨੂੰ ਨਹੀਂ ਵੀ ਬੋਲਣੀ ਆਉਂਦੀ ਉਹ ਸਿੱਖਦੇ ਨੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਪੰਜਾਬੀ ਬੋਲ ਕੇ ਅਤੇ ਜਿਹੜੇ ਅੱਜ ਕੱਲ੍ਹ ਦੇ ਪ੍ਰਾਈਵੇਟ ਸਕੂਲ ਆ ਉਹਨਾਂ ਵਿੱਚ ਬਹੁਤ ਹੀ ਘੱਟ ਜਿਹੜੀ ਪੰਜਾਬੀ ਬੋਲੀ ਜਾਂਦੀ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਤਾਂ ਨਾ ਮਾਤਰ ਹੀ ਪੰਜਾਬੀ ਹੋ ਚੁੱਕੀ ਆ ਕਿ ਉਹ ਜਿਹੜੇ ਪੰਜਾਬੀ ਨੂੰ ਨਹੀਂ ਬੋਲਦੇ ਇਹ ਉਹਨਾਂ ਦੀ ਬਹੁਤ ਵੱਡੀ ਗਲਤ ਗੱਲ ਆ ਉਹਨਾਂ ਨੂੰ ਸਗੋਂ ਪੰਜਾਬੀ ਰੱਖਣੀ ਚਾਹੀਦੀ ਕਿਉਂਕਿ ਉਹ ਪੰਜਾਬ ਦੀ ਮਾਂ ਬੋਲੀ ਹੈ ਅਤੇ ਇਸ ਕਰਕੇ ਉਹਨਾਂ ਨੂੰ ਪੰਜਾਬੀ ਰੱਖਣੀ ਚਾਹੀਦੀ ਹੈ ਨਿਆਣਿਆਂ ਨੂੰ ਪੰਜਾਬੀ ਬੋਲਣੀ ਦੇਣੀ ਚਾਹੀਦੀ ਹੈ ਉਹਨਾਂ ਦਾ ਨਿਆਣਿਆਂ ਨੂੰ ਬੋਲਣ 'ਤੇ ਵੀ ਪਾਬੰਦੀ ਲਾ ਦਿੱਤੀ ਜਾਂਦੀ ਜੇ ਸਕੂਲ ਵਿੱਚ ਪੰਜਾਬੀ ਪੜ੍ਹਨੀ ਨਹੀਂ ਰੱਖੀ ਨਾ ਦਿਖਣੀ ਜੇ ਰੱਖੀ ਹੈ ਤਾਂ ਉਹਨਾਂ ਨੂੰ ਬੋਲਣ 'ਤੇ ਵੀ ਪਾਬੰਦੀ ਲਾ ਦਿੱਤੀ ਜਾਂਦੀ ਹੈ ਪਰ ਇਹ ਬਹੁਤ ਵੱਡੀ ਗਲਤੀ ਹੈ ਉਹਨਾਂ ਪ੍ਰਾਈਵੇਟ ਸਕੂਲਾਂ ਦੀ ਸਗੋਂ ਉਹਨਾਂ ਨੂੰ ਬੱਚਿਆਂ ਨੂੰ ਵੀ ਕਹਿਣਾ ਚਾਹੀਦਾ ਕਿ ਤੁਸੀਂ ਪੰਜਾਬੀ ਬੋਲੋ ਵਧੀਆ ਕਿਉਂਕਿ ਉਹਨਾਂ ਦੀ ਮਾਂ ਬੋਲੀ ਹੈ ਬੋਲਣੀ ਚਾਹੀਦੀ ਹੈ ਅਤੇ ਇਹਨੂੰ ਜਿਹੜੀ ਸਾਡੀ ਪੰਜਾਬੀ ਵਿਰਾਸਤ ਸੱਭਿਆਚਾਰ ਵਿਰਾਸਤ ਹੈ ਉਹਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਪੁਰਾਣੇ ਸਮੇਂ ਦੀ ਹੈ ਜਿੰਨੇ ਸਾਨੂੰ ਵਧੀਆ ਅੱਗੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਕਿ ਪੁਰਾਣੇ ਸਮੇਂ 'ਚ ਕੀ ਹੁੰਦਾ ਰਿਹਾ ਕਿਵੇਂ ਸੀ ਕੀ ਹੀ ਕਿੱਦਾਂ ਅਸੀਂ ਇੰਨੇ ਪੁਰਾਣੇ ਸਮੇਂ ਤੋਂ ਕਿੱਥੋਂ ਅਸੀਂ ਕੀ ਬਣੇ ਇਹਨਾਂ ਵਿਰਾਸਤਾਂ ਨੂੰ ਜੇ ਅਸੀਂ ਸਾਂਭ ਕੇ ਰੱਖਾਂਗੇ ਤਾਂ ਹੀ ਉਹਨਾਂ ਪੁਰਾਣੇ ਲੋ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇਗਾ ਕਿ ਜਿਹੜਾ ਪੁਰਾਣਾ ਸਮੇਂ 'ਚ ਕੀ ਹੁੰਦਾ ਸੀ ਕੀ ਨਹੀਂ ਜੇ ਅਸੀਂ ਇਹਨਾਂ ਨੂੰ ਸੰਭਾਲ ਕੇ ਨਹੀਂ ਰੱਖਦੇ ਤਾਂ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਹੁੰਦਾ ਸੀ ਪੁਰਾਣੇ ਸਮੇਂ 'ਚ ਕੀ ਨਹੀਂ ਜਾਂ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਆ ਉਹਦੀ ਬਹੁਤ ਵੱਡੀ ਭੂਮਿਕਾ ਆ ਜਿੱਥੋਂ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਪਤਾ ਲੱਗ ਜਾਂਦਾ ਹੈ ਨਾ ਕਿ ਹਰ ਇੱਕ ਨੂੰ ਜਿਹੜੀ ਪੰਜਾਬੀ ਆ ਉਹ ਬੋਲਣੀ ਵੀ ਸੌਖੀ ਆ ਅਤੇ ਸਭ ਨੂੰ ਪਤਾ ਵੀ ਲੱਗ ਜਾਂਦਾ ਕਿ ਹਾਂ ਕਿ ਲੋਕ ਕੀ ਗੱਲ ਕਰ ਰਹੇ ਕੀ ਨਹੀਂ ਅਤੇ ਇਹਦਾ ਬਹੁਤ ਯੋਗਦਾਨ ਵੀ ਆ ਸਾਡੇ ਲਈ